ਇੱਕ ਮਈ ਉੱਨੀ ਸੌ ਸਤੱਤਰ ਸੱਤ ਮਾਰਚ ਦੋ ਹਜ਼ਾਰ ਚਾਰ ਪੰਜ ਸਤੰਬਰ ਦੋ ਹਜ਼ਾਰ ਇੱਕ ਚੌਵੀ ਦਸੰਬਰ ਉੱਨੀ ਸੌ ਛੇਆਹਠ ਤੇਰਾਂ ਅਗਸਤ ਉੱਨੀ ਸੌ ਸੰਤਾਲੀ